ਹੈਲੋ ਹਾਂਜੀ ਤੁਸੀਂ ਕਮਲ ਪੰਜਾਬੀ ਸਟੋਰ ਤੋਂ ਬੋਲ ਰਹੇ ਹੋ ਜੀ ਅੱਛਾ ਜੀ ਜਿਹੜਾ ਥ੍ਰੀ ਬੀ ਵਨ ਦੇ ਵਿੱਚ ਹੈ ਜੀ ਅੱਛਾ ਜੀ ਪਹਿਲਾਂ ਮੈਂ ਕੀ ਮੈਂ ਤੁਹਾਡਾ ਨਾਮ ਪੁੱਛ ਸਕਦੀ ਹਾਂ ਜੀ ਓਕੇ ਜਸਵੀਰ ਜੀ ਮੈਂ ਥੋੜ੍ਹਾ ਜਿਹਾ ਤੁਹਾਡੀ ਦੁਕਾਨ ਬਾਰੇ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਮੈਂ ਥੋੜ੍ਹੀਆਂ ਜਿਹੀਆਂ ਡਰੈਸਿਸ ਲੈਣੀਆਂ ਚਾਹੁੰਦੀ ਸੀਗੀ ਜਾਗੋ ਦੇ ਫੰਕਸ਼ਨ ਦੇ ਲਈ ਮੈਨੂੰ ਇੱਕ ਗੱਲ ਦੱਸੋ ਕੀ ਤੁਹਾਡੀ ਦੁਕਾਨ 'ਤੇ ਘੱਗਰੇ ਮਿਲ ਜਾਣਗੇ ਓਕੇ ਜੀ ਕੀ ਤੁਹਾਡੇ ਕੋਲ ਫੁਲਕਾਰੀਆਂ ਵੀ ਹੈਗੀਆਂ ਓਕੇ ਜੀ ਇੱਕ ਮੈਨੂੰ ਗੱਲ ਤੁਸੀਂ ਦੱਸੋ ਵੀ ਕੀ ਘੱਗਰੇ ਅਤੇ ਫੁਲਕਾਰੀਆਂ ਦੇ ਨਾਲ ਨਾਲ ਕੀ ਆਪਾਂ ਪੰਜਾਬੀ ਜਿਹੜੀ ਜਿਊਲਰੀ ਆ ਉਹ ਵੀ ਸਾਨੂੰ ਤੁਸੀਂ ਪ੍ਰੋਵਾਈਡ ਕਰਵਾ ਦਿਉਂਗੇ ਓਕੇ ਜੀ ਅਤੇ ਇਸ ਵਾਰ ਕੀ ਮੈਨੂੰ ਰੈਂਟ ਦਾ ਥੋੜ੍ਹਾ ਜਿਹਾ ਸਿਸਟਮ ਦੱਸੋਂਗੇ ਵੀ ਕੀ ਰੈਂਟ ਲੈਂਦੇ ਹੋ ਤੁਸੀਂ ਵੀ ਜੇ ਅਸੀਂ ਇੱਕ ਦਿਨ ਦੇ ਲਈ ਜ਼ਾਂ ਦੋ ਦਿਨ ਦੇ ਲਈ ਲੈਣਾ ਹੋਵੇ ਓਕੇ ਕੀ ਤੁਸੀਂ ਐਡਵਾਂਸ ਵੀ ਲੈਂਦੇ ਹੋ ਥੋੜ੍ਹਾ ਓਕੇ ਜੀ ਮੈਂ ਪੰਜ ਤਰੀਕ ਦੇ ਲਈ ਬੁੱਕ ਕਰਵਾ ਕੇ ਜਾਣਾ ਚਾਹੁੰਦੀ ਹਾਂ ਪੰਜ ਦਸੰਬਰ ਦੇ ਲਈ ਅਤੇ ਉਸ ਲਈ ਮੈਂ ਕਦੋਂ ਤੁਹਾਡੀ ਦੁਕਾਨ 'ਤੇ ਆ ਸਕਦੀ ਹਾਂ ਕੀ ਟਾਈਮਿੰਗਸ ਨੇ ਤੁਹਾਡੇ ਓਕੇ ਧੰਨਵਾਦ ਜੀ ਮੈਂ ਜ਼ਰੂਰ ਵਿਜ਼ਿਟ ਕਰੂੰਗੀ ਅੱਜ ਜ਼ਾਂ ਕੱਲ੍ਹ ਦੇ ਵਿੱਚ ਓਕੇ ਥੈਂਕ ਯੂ